ਪੰਜਾਬੀ ਭਾਸ਼ਾ ਹੁਣ ਸਿਰਫ਼ ਪੰਜਾਬ ਤੱਕ ਹੀ ਸੀਮਿਤ ਨਹੀਂ ਹੈ ਪੰਜਾਬੀ ਭਾਸ਼ਾ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਚੁੱਕੀ ਹੈ ਇਹ ਬਾਹਰਲੇ ਦੇਸ਼ਾਂ ਤੱਕ ਪਹੁੰਚ ਚੁੱਕੀ ਹੈ ਇਹ ਹੁਣ ਕੈਨੇਡਾ ਦੀ ਦੂਜੀ ਰਾਜ ਭਾਸ਼ਾ ਹੈ ਇਹ ਪੰਜਾਬ ਦੇ ਪ ਪੰਜਾਬੀ ਫਿਲਮਾਂ ਅਤੇ ਪੰਜਾਬੀ ਗੀਤਾਂ ਰਾਹੀਂ ਬਹੁਤ ਮਸ਼ਹੂਰ ਹੋ ਚੁੱਕੀ ਹੈ ਇਸ ਨੂੰ ਹਰ ਸਟੇਟ ਵਿੱਚ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਜ਼ਿਆਦਾ ਅੱਗੇ ਪਹੁੰਚ ਚੁੱਕੀ ਹੈ